ਪਹਿਲਾਂ ਦੇ ਸਮੇਂ ਵਿੱਚ ਤੈਕਨੋਲਜੀ ਬਹੁਤ ਹੀ ਘੱਟ ਸੀ ਜਿਸ ਕਾਰਨ ਅਸੀਂ ਕੋਈ ਵੀ ਪੱਤਰ ਲਿਖਦੇ ਸੀ ਤਾਂ ਸਾਨੂੰ ਉਹ ਪੱਤਰ ਭੇਜਣ ਵਿੱਚ ਬਹੁਤ ਹੀ ਦਿਨ ਲੱਗ ਜਾਂਦੇ ਸੀ ਅਤੇ ਉਸਦਾ ਜਵਾਬ ਪਾਉਣ ਵਿੱਚ ਬਹੁਤ ਦਿਨ ਲੱਗ ਜਾਂਦੇ ਸਨ ਜਦੋਂ ਤੱਕ ਉਹ ਕੰਮ ਹੋ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਐਸਾ ਕੁਝ ਨਹੀਂ ਅੱਜ ਦੇ ਸਮੇਂ ਵਿੱਚ ਤੈਕਨੋਲਜੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਕਾਫੀ ਸਾਰੇ ਐਪ ਬਣ ਗਏ ਹਨ ਜਿਵੇਂ ਕਿ ਵਟਸਐਪ ਫੇਸਬੁੱਕ ਇੰਸਟਾਗ੍ਰਾਮ ਸਨੈਪਚੈਟ ਟਵੀਟਰ ਆਦਿ ਇਹ ਸਾਰੇ ਐਪਾਂ ਰਾਹੀਂ ਅਸੀਂ ਕਿਸੇ ਵੀ ਵਿਅਕਤੀ ਨਾਲ ਗੱਲ ਕਰ ਸਕਦੇ ਹਾਂ ਅਸੀਂ ਕਿਸੇ ਵਿਅਕਤੀ ਨੂੰ ਦੇਖ ਵੀ ਸਕਦੇ ਹਾਂ ਵੀਡੀਓ ਕੋਲ ਰਾਹੀਂ ਅਤੇ ਉਹ ਕਿੱਥੇ ਹੈ ਅਸੀਂ ਉਸ ਦੀ ਲੋਕੇਸ਼ਨ ਵੀ ਪਤਾ ਕਰ ਸਕਦੇ ਹਾਂ ਅੱਜ ਕੱਲ੍ਹ ਤਕਨੋਲਜੀ ਨੇ ਬਹੁਤ ਹੀ ਜ਼ਿਆਦਾ ਆ ਵਿਕਸਿਤ ਹੋ ਗਈ ਹੈ ਅਸੀਂ ਤੈਕਨੋਲਜੀ ਨਾਲ ਕਿਸੇ ਵੀ ਵਿਅਕਤੀ ਨੂੰ ਕਿੱਥੇ ਵੀ ਵੇਖ ਸਕਦੇ ਹਾਂ ਉਹ ਜਿਹੜੀ ਮਰਜ਼ੀ ਥਾਂ 'ਤੇ ਹੋਵੇ ਅਸੀਂ ਉਹਨਾਂ ਦੀ ਲੋਕੇਸ਼ਨ ਵੀ ਪਤਾ ਕਰ ਸਕਦੇ ਹਾਂ ਅਸੀਂ ਵਟਸਐਪ ਰਾਹੀਂ ਵੀ ਉਹਨਾਂ ਨੂੰ ਮੈਸਿਜ ਕਰ ਸਕਦੇ ਹਾਂ ਅਤੇ ਤੁਰੰਤ ਆਪਣਾ ਜਵਾਬ ਪ੍ਰਾਪਤ ਕਰ ਸਕਦੇ ਹਾਂ ਅਸੀਂ ਵੀਡੀਓ ਕਾਲ ਰਾਹੀਂ ਕਿਸੀ ਵਿਅਕਤੀ ਨੂੰ ਵੀ ਦੇਖ ਸਕਦੇ ਹਾਂ ਭਾਵੇਂ ਉਹ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਬੈਠਾ ਹੋਵੇ ਇਹ ਤੈਕਨੋਲਜੀਆਂ ਬਹੁਤ ਹੀ ਚੰਗੀਆਂ ਹਨ ਅਤੇ ਸਾਰੇ ਲੋਕਾਂ ਲਈ ਬਹੁਤ ਹੀ ਜ਼ਰੂਰੀ ਹਨ